ਪਹਿਲੀ ਗੱਲ ਮੈਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਅੱਜ ਕੱਲ੍ਹ ਜਿਹੜੀ ਅਬਾ ਆਬਾਦੀ ਵੱਧ ਰਹੀ ਹੈ ਸਰਕਾਰ ਨੂੰ ਇਸਦੇ ਉੱਪਰ ਬਹੁਤ ਹੀ ਨਿਯੰਤਰਣ ਦੇਣ ਦੀ ਅਵਸ਼ੱਕਤਾ ਹੈ ਸਰਕਾਰ ਲੋਕਾਂ 'ਤੇ ਧਿਆਨ ਦਿੰਦੀ ਨਹੀਂ ਹੈ ਜਿਸ ਕਰਕੇ ਆਬਾਦੀ ਬਹੁਤ ਜ਼ਿਆਦਾ ਵੱਧ ਰਹੀ ਹੈ ਬੱਸਾਂ ਓਟੋ ਰਿਕਸ਼ਾ ਇਹਨ ਇਹਨਾਂ ਦੀ ਸਰਵਿਸ ਐਨੀ ਜ਼ਿਆਦਾ ਖਰਾਬ ਹੈ ਸ਼ਹਿਰਾਂ 'ਚ ਪਿੰਡਾਂ 'ਚ ਓਟੋ ਰਿਕਸ਼ਾ ਮਿਲਦੇ ਹੀ ਨਹੀਂ ਹਨ ਅ ਰਸਤਿਆਂ 'ਚ ਐਨੀ ਜ਼ਿਆਦਾ ਟ੍ਰੈਫਿਕ ਵੱਧ ਚੁੱਕੀ ਹੈ ਅਤੇ ਟ੍ਰੈਫਿਕ ਪੁਲਿਸ ਉੱਥੇ ਹੁੰਦੀ ਹੀ ਨਹੀਂ ਹੈ ਟ੍ਰੈਫਿਕ ਵੱਧ ਜਾਂਦੀ ਹੈ ਜਿਸਦੇ ਕਾਰਨ ਐਕਸੀਡੈਂਟ ਹੋ ਰਹੇ ਹਨ ਸਰਕਾਰ ਇਹ ਚੀਜ਼ਾਂ 'ਤੇ ਬਿਲਕੁਲ ਧਿਆਨ ਨਹੀਂ ਦੇ ਰਹੀ ਹੈ ਹੋਸਪਿਟਲ ਤਾਂ ਹੋਸਪਿਟਲਾਂ ਦੀ ਹਾਲਤ ਐਨੀ ਜ਼ਿਆਦਾ ਬੇਕਾਰ ਹੈ ਉੱਥੇ ਕੋਈ ਸਫਾਈ ਨਹੀਂ ਹੈ ਕੋਈ ਬੈੱਡ ਦੀ ਅਰੇਂਜਮੈਂਟਸ ਨਹੀਂ ਹਨ ਸਾਰਾ ਕੁਛ ਖਰਾਬ ਹੋ ਚੁੱਕਿਆ ਐਜੂਕੇਸ਼ਨ ਸਿਸਟਮ ਐਨਾ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਸਕੂਲ ਐਨੇ ਜ਼ਿਆਦਾ ਬੇਕਾਰ ਹੋ ਚੁੱਕੇ ਹਨ ਨਾ ਉੱਥੇ ਸ ਪੜ੍ਹਾਈ ਵਧੀਆ ਹੁੰਦੀ ਹੈ ਨਾ ਬੱਚੇ ਚੰਗੇ ਹੁੰਦੇ ਹਨ ਇੱਥੇ ਮਹਿੰਗਾਈ ਸ਼ਹਿਰਾਂ ਵਿੱਚ ਐਨੀ ਵੱਧ ਚੁੱਕੀ ਹੈ ਕਿ ਆਮ ਲੋਕਾਂ ਦਾ ਜੀਣਾ ਬਹੁਤ ਹੀ ਦੁਸ਼ਵਾਰ ਹੋ ਚੁੱਕਿਆ ਹੈ ਨੋਰਮਲ ਲੋਕ ਜਿਹੜੇ ਹੈ ਉਹ ਰਹਿ ਵੀ ਨਹੀਂ ਸਕਦੇ ਸ਼ਹਿਰਾਂ 'ਚ ਐਨੀ ਜ਼ਿਆਦਾ ਮਹਿੰਗਾਈ ਵੱਧ ਚੁੱਕੀ ਹੈ ਸਬਜ਼ੀਆਂ 'ਤੇ ਰਾਸ਼ਨ 'ਤੇ ਸਲੰਡਰ ਹੋ ਗਏ ਸਾਰਾ ਕੁਛ ਹੀ ਬਹੁਤ ਜ਼ਿਆਦਾ ਮਹਿੰਗਾ ਹੋ ਚੁੱਕਿਆ ਹੈ ਜਿਸ ਕਰਕੇ ਦੇਸ਼ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਜੋਬਸ ਹੈ ਜਿਹੜੀਆਂ ਉਹ ਵੀ ਬਹੁਤ ਜ਼ਿਆਦਾ ਸ਼ੋਰਟਏਜ ਹੋ ਚੁੱਕੀ ਹੈ ਬੱਚੇ ਅੱਜ ਕੱਲ੍ਹ ਦੇ ਨੌਜਵਾਨ ਡਿਗਰੀਆਂ ਲੈ ਕੇ ਵਿਹਲੇ ਘੁੰਮ ਰਹੇ ਹਨ ਕੋਈ ਜੋਬਸ ਉਹਨਾਂ ਨੂੰ ਪ੍ਰੋਵਾਈਡ ਨਹੀਂ ਕੀਤੀ ਜਾਂਦੀ ਮੇਰੀ ਸਰਕਾਰ ਨੂੰ ਇਹੀ ਅਪੀਲ ਹੈ ਕਿ ਥੋੜ੍ਹਾ ਜਾਂ ਥੋੜ੍ਹੀ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਜਿਹੜੀ ਸਾਡੀ ਪੋਪੂਲੇਸ਼ਨ ਹੈ ਥੋੜ੍ਹੀ ਘੱਟ ਹੋ ਸਕੇ ਬੱਸਾਂ ਹੈ ਜਿਹੜੀਆਂ ਓਟੋ ਰਿਕਸ਼ਾਜ ਹੈ ਇਹਨਾਂ ਦੀ ਕੰਡੀਸ਼ਨ ਸਹੀ ਹੋ ਸਕਣ ਜਿਹੜੀ ਟ੍ਰੈਫਿਕ ਪੁਲਿਸ ਹੈ ਪ੍ਰੋਵਾਈਡ ਕੀਤੀ ਜਾਵੇ ਸੜਕਾਂ 'ਤੇ ਤਾਂ ਕਿ ਜਿਹੜੇ ਐਕਸੀਡੈਂਟਸ ਹੈ ਉਹ ਬਹੁਤ ਘੱਟ ਹੋਣ ਹੋਸਪਿਟਲ ਹੈ ਜਿਹੜੇ ਉਹਨਾਂ ਦੀ ਸਾਫ਼ ਸਫ਼ਾਈ ਕੀਤੀ ਜਾਵੇ ਐਜੂਕੇਸ਼ਨ ਸਿਸਟਮ ਨੂੰ ਥੋੜ੍ਹਾ ਵਧੀਆ ਕੀਤਾ ਜਾਵੇ ਮਹਿੰਗਾਈ ਜਿਹੜੀ ਹੈ ਘੱਟ ਕੀਤੀ ਜਾਵੇ ਸਲੰਡਰ ਅੱਜ ਗਿਆਰ੍ਹਾਂ ਸੌ ਤੱਕ ਪਹੁੰਚ ਚੁੱਕੇ ਹਨ ਮਹਿੰਗਾਈ ਐਨੀ ਜ਼ਿਆਦਾ ਵੱਧ ਰਹੀ ਹੈ ਗਰੀਬ ਲੋਕਾਂ ਦਾ ਰਹਿਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਚੁੱਕਿਆ ਹੈ ਅਤੇ ਜਿਹੜੀ ਹੈ ਨੌਜਵਾਨਾਂ ਨੂੰ ਜੋ ਕਿ ਹੈ ਜੋਬਸ ਜਿਹੜੀਆਂ ਹੈ ਉਹ ਪ੍ਰੋਵਾਈਡ ਕੀਤੀ ਜਾਣ ਇਹੀ ਮੇਰਾ ਸਰਕਾਰ ਨੂੰ ਮੇਰੀ ਇਹੀ ਅਪੀਲ ਹੈ ਕਿ ਇਹ ਚੀਜ਼ਾਂ 'ਤੇ ਥੋੜ੍ਹਾ ਜਿਹਾ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈ ਧੰਨਵਾਦ